ਸਾਲ ਭਰ ਵਿੱਚ ਵੱਖ ਵੱਖ ਮੌਸਮਾਂ ਵਿੱਚ ਸਾਡੇ ਖੇਤਰ ਵਿੱਚ ਬਹੁਤ ਸਾਰੀਆਂ ਫਸਲਾਂ ਜਿਹੜੀਆਂ ਵਾ ਉਹ ਬੀਜੀਆਂ ਜਾਂਦੀਆਂ ਹਨ ਜਿਵੇਂ ਮੱਕੀ ਦਾਲਾਂ ਛੋਲੇ ਬਾਜਰਾ ਜਵਾਰ ਕਣਕ ਝੋਨਾ ਆਦਿ ਸੌ ਇਹਨਾਂ ਮੌਸਮ ਦੇ ਵਿੱਚ ਇਹਨਾਂ ਫਸਲਾਂ ਦਾ ਜਦੋਂ ਪੁੰਗਰਨ ਹੁੰਦਾ ਆ ਤਾਂ ਉਹਦੇ ਲਈ ਉਹ ਮੌਸਮ ਵੀ ਉਹੋ ਜਿਹਾ ਹੀ ਹੋਣਾ ਚਾਹੀਦਾ ਹੈ ਮੰਨ ਲਓ ਕਿ ਆਪਾਂ ਕਣਕ ਬੀਜ ਰਹੇ ਹਾਂ ਤਾਂ ਉਹਦੇ ਵਾਸਤੇ ਸਾਨੂੰ ਕਣਕ ਜਿਵੇਂ ਕਣਕ ਦੀ ਤਸੀਰ ਗਰਮ ਹੁੰਦੀ ਹੈ ਉਹਦੇ ਵਾਸਤੇ ਸਾਨੂੰ ਠੰਡਾ ਮੌਸਮ ਚਾਹੀਦਾ ਹੈ ਸੋ ਉਹ ਸਰਦੀਆਂ ਵਿੱਚ ਅਕਤੂਬਰ ਨਵੰਬਰ ਦਿਸੰਬਰ ਤੱਕ ਅਕਤੂਬਰ ਨਵੰਬਰ ਹੀ ਮੇਨ ਇਹਨਾਂ ਦਾ ਹੈਗਾ ਹੈ ਪੁੰਗਰਨ ਦਾ ਮੌਸਮ ਉਦੋਂ ਬੀਜੀ ਜਾਂਦੀ ਹੈ ਜਿਹੜਾ ਝੋਨਾ ਹੈ ਉਹ ਜਿਹੜਾ ਉਹ ਗਰਮੀਆਂ ਦੇ ਵਿੱਚ ਸਾਉਣ ਭਾਦੋਂ ਦੇ ਮਹੀਨੇ ਵਿੱਚ ਬੀਜਿਆ ਜਾਂਦਾ ਹੈ ਕਿਉਂਕਿ ਉਹਨੂੰ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਜਿਹੜੀਆਂ ਦਾਲਾਂ ਨੇ ਉਹ ਵੀ ਜਿਹੜੇ ਜਦੋਂ ਵਧੀਆ ਮੌਸਮ ਹੁੰਦਾ ਨਾ ਗਰਮੀ ਨਾ ਸਰਦੀ ਦਾ ਉਦੋਂ ਬੀਜੀਆਂ ਜਾਂਦੀਆਂ ਹਨ ਮੱਕੀ ਦੀ ਫਸਲ ਜਿਹੜੀ ਆ ਉਹ ਵੀ ਠੰ ਜ਼ਿਆਦਾ ਠੰਡ ਵਿੱਚ ਨਹੀਂ ਹੁੰਦੀ ਨਾ ਜ਼ਿਆਦਾ ਗਰਮੀ ਵਿੱਚ ਹੁੰਦੀ ਹੈ ਉਹਦਾ ਵੀ ਸਤੰਬਰ ਅਕਤੂਬਰ ਦਾ ਮਹੀਨਾ ਹੁੰਦਾ ਹੈ ਸੋ ਇਹ ਪੰਜਾਬ ਦੀਆਂ ਮੇਨ ਜਿਹੜੀਆਂ ਫਸਲਾਂ ਹਨ ਇਹ ਬੀਜੀਆਂ ਜਾਂਦੀਆਂ ਹਨ ਇਹਨਾਂ ਮੌਸਮਾਂ ਦੇ ਵਿੱਚ ਅਤੇ ਉਹਨਾਂ ਲਈ ਇਹ ਮੌਸਮ ਵੀ ਜਿਹੜਾ ਆ ਉਹ ਢੁੱਕਵਾਂ ਹੁੰਦਾ ਹੈ ਇਸ ਤੋਂ ਇਲਾਵਾ ਜੇਕਰ ਅਸੀਂ ਉਹਨਾਂ ਨੂੰ ਫਸਲਾਂ ਨੂੰ ਬੀਜਦੇ ਹਾਂ ਤਾਂ ਉਹਨਾਂ ਦਾ ਮਤਲਬ ਕਿੰਨਾ ਝਾੜ ਨਿਕਲਦਾ ਹੈ ਅਤੇ ਨਾ ਉਹਨਾਂ ਦਾ ਪੁੰਗਰਨ ਚੰਗੀ ਤਰ੍ਹਾਂ ਹੁੰਦਾ ਹੈ ਧੰਨਵਾਦ